ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਜਿਸ ਕਰਕੇ ਮੈਂ ਬਹੁਤ ਸਾਰੀਆਂ ਲਾਈਬ੍ਰੇਰੀਆਂ ਵਿੱਚ ਗਿਆ ਹਾਂ ਅਤੇ ਮੈਂ ਬਹੁਤ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਹਨ ਕਿਤਾਬਾਂ ਇੱਕ ਹਿਸਾਬ ਦੀਆਂ ਮੇਰੇ ਸੱਚੇ ਦੋਸਤ ਹਨ ਕਿਤਾਬਾਂ ਪੜ੍ਹਨ ਦੇ ਬਹੁਤ ਸਾਰੇ ਫ਼ਾਇਦੇ ਹਨ ਮੈਂ ਲਾਈਬ੍ਰੇਰੀ ਵਿੱਚ ਜਾਣਾ ਬਹੁਤ ਪਸੰਦ ਕਰਦਾ ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਲਾਈਬ੍ਰੇਰੀ ਇੱਕ ਤਰ੍ਹਾਂ ਦਾ ਮੇਰਾ ਦੂਜਾ ਘਰ ਹੀ ਹੈ ਮੈਂ ਅਕਸਰ ਲਾਈਬ੍ਰੇਰੀ ਵਿੱਚ ਜਾਂਦਾ ਰਹਿੰਦਾ ਹਾਂ ਆਪਣੇ ਸਕੂਲ ਦੀ ਲਾਈਬ੍ਰੇਰੀ ਤੋਂ ਲੈ ਕੇ ਹੁਣ ਕਾਲਜ ਦੀ ਲਾਈਬ੍ਰੇਰੀ ਵਿੱਚ ਵੀ ਮੈਨੂੰ ਸਮਾਂ ਬਿਤਾਉਣਾ ਅਤੇ ਕਿਤਾਬਾਂ ਪੜ੍ਹਨਾ ਬਹੁਤ ਪਸੰਦ ਹੈ ਸਕੂਲ ਅਤੇ ਕਾਲਜ ਤੋਂ ਬਾਹਰ ਵੀ ਮੈਂ ਆਪਣੇ ਮੁਹੱਲੇ ਅਤੇ ਆਪਣੇ ਸ਼ਹਿਰ ਦੀ ਮਸ਼ਹੂਰ ਬਿੰਟਨ ਲਾਈਬ੍ਰੇਰੀ ਵੀ ਗਿਆ ਹਾਂ ਅਤੇ ਉੱਥੇ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਮੈਂ ਆਪਣੇ ਘਰ ਵਿੱਚ ਵੀ ਆਪਣੀ ਇਕ ਨਿੱਜੀ ਲਾਈਬ੍ਰੇਰੀ ਬਣਾਈ ਹੈ ਜਿਸ ਵਿੱਚ ਮੈਂ ਅਲੱਗ ਅਲੱਗ ਖਾਨੇ ਬਣਾਏ ਹਨ ਜਿਵੇਂ ਸੱਭਿਆਚਾਰਕ ਵਾਲੇ ਕਿਤਾਬਾਂ ਦਾ ਵੱਖ ਅਲੱਗ ਖਾਨਾ ਅਤੇ ਸ ਅਤੇ ਇਤਿਹਾਸਿਕ ਵਾਲਾ ਵੱਖਰਾ ਹਨ ਮੈਨੂੰ ਕਿਤਾਬਾਂ ਪੜ੍ਹਨ ਦਾ ਸੌਂਕ ਸ਼ੁਰੂ ਤੋਂ ਸੀ ਜਿਸ ਕਰਕੇ ਮੇਰੇ ਘਰਦਿਆਂ ਨੇ ਮੈਨੂੰ ਇੱਕ ਮੇਰੀ ਵੱਖਰੀ ਲਾਈਬ੍ਰੇਰੀ ਬਣਾ ਦਿੱਤੀ ਮੈਂ ਉੱਥੇ ਅਕਸਰ ਅਲਗ ਅਲਗ ਕਿਤਾਬਾਂ ਪੜ੍ਹਦਾ ਹਾਂ ਜਿਵੇਂ ਕਿ ਕੁਝ ਇਮੋਸ਼ਨਲ ਕਿਤਾਬਾਂ ਅਤੇ ਕੁਝ ਖੇਡਣ ਵਾਲੀਆਂ ਕਿਤਾਬਾਂ ਕਿਤਾਬਾਂ ਤੋਂ ਬਾਵਜੂਦ ਅਖ਼ਬਾਰਾਂ ਅਤੇ ਮੈਗਜ਼ੀਨ ਦਾ ਵੀ ਬਹੁਤ ਜ਼ਿਆਦਾ ਫ਼ਾਇਦੇ ਹਨ ਜੋ ਕਿ ਸਾਨੂੰ ਪੜ੍ਹਨ ਤੋਂ ਮਿਲਦੇ ਹਨ ਲਾਈਬ੍ਰੇਰੀ ਵਿੱਚ ਸਮਾਂ ਬਿਤਾਉਣਾ ਬਹੁਤ ਹੀ ਚੰਗਾ ਲੱਗਦਾ ਹੈ ਸਾਨੂੰ ਆਪਣੀ ਲਾਈਬ੍ਰੇਰੀ ਅਲੱਗ ਬਣਾਉਣੀ ਚਾਹੀਦੀ ਹੈ ਮੇਰੀ ਇੱਕ ਸੁਪਨੇ ਦੀ ਲਾਈਬ੍ਰੇਰੀ ਵੀ ਹੈ ਉਸ ਲਾਈਬ੍ਰੇਰੀ ਵਿੱਚ ਮੈਂ ਇਹ ਚਾਹੁੰਦਾ ਹਾਂ ਕਿ ਹਰ ਇੱਕ ਦੁਨੀਆਂ ਦੀ ਕਿਤਾਬ ਉਸ ਵਿੱਚ ਹੋਵੇ ਅਤੇ ਜਿਹੜੀ ਕਿਤਾਬ ਮੈਂ ਚਾਹਵਾਂ ਮੈਨੂੰ ਉਹ ਆਰਾਮ ਨਾਲ ਮਿਲ ਜਾਵੇ ਅਤੇ ਮੈਂ ਉਹ ਪੜ੍ਹਾਂ ਲਾਈਬ੍ਰੇਰੀ ਵਿੱਚ ਇੱਦਾਂ ਦੀ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਸਾਨੂੰ ਆਕਰਸ਼ਕ ਕਰਨ ਕਿ ਅਸੀਂ ਉਹਨਾਂ ਨੂੰ ਪੜ੍ਹੀਏ ਧੰਨਵਾਦ